ਸਤਿ ਸ਼੍ਰੀ ਅਕਾਲ ਰਜਨੀ ਮੈਂ ਭਾਵਨਾ ਬੋਲਦੀ ਪਈ ਹਾਂ ਅਤੇ ਥੋੜ੍ਹੀ ਦਿਨ ਪਹਿਲਾਂ ਤੇਰੀ ਮੇਰੀ ਗੱਲ ਹੋਈ ਸੀ ਕਿ ਤੂੰ ਕਿਸੇ ਸ਼ਿਵਾ ਟਰੈਵਲਿੰਗ ਏਜੰਸੀ ਨੂੰ ਜਾਣਦੀ ਹੈ ਅਤੇ ਮੇਰੀ ਕੱਲ੍ਹ ਪਰਸੋਂ ਮੇਰੇ ਅੰਮ੍ਰਿਤਸਰ ਯਾਤਰਾ ਕਰਨ ਦਾ ਮੂਡ ਹੈ ਅਤੇ ਕੀ ਤੂੰ ਉਸ ਬਾਰੇ ਮੈਨੂੰ ਥੋੜ੍ਹੀ ਬਹੁਤੀ ਹੋਰ ਜਾਣਕਾਰੀ ਦੇ ਸਕਦੀ ਹੈ ਤੂੰ ਦੱਸਿਆ ਸੀ ਕਿ ਉਹਨਾਂ ਦੀ ਸ਼ਿਵਾ ਟਰੈਵਲਿੰਗ ਏਜੰਸੀ ਦੀ ਜਿਹੜੀ ਫੈਸਿਲਿਟੀਆਂ ਆ ਬਹੁਤ ਚੰਗੀਆਂ ਹਨ ਉਹਨਾਂ ਦੇ ਰੇਟ ਬੜੇ ਜੈਨੁਅਲ ਹੈ ਅਤੇ ਕੀ ਤੂੰ ਮੈਨੂੰ ਉਹਦੇ ਬਾਰੇ ਉਹਨਾਂ ਦੇ ਡਰਾਈਵਰਾਂ ਬਾਰੇ ਕੁਛ ਦੱਸ ਸਕਦੀ ਹੈ ਕਿ ਕੀ ਉਹ ਰਸਤੇ ਦੇ ਵਿੱਚ ਜਿੱਦਾਂ ਤੂੰ ਜਾਣਦੀ ਹੈ ਕਿ ਮੇਰੇ ਬੱਚੇ ਸ਼ਰਾਰਤੀ ਹੈ ਜਾਂ ਕਿਸੇ ਵੇਲੇ ਰਸਤੇ ਵਿੱਚ ਕੋਈ ਰੁਕ ਕੇ ਕੋਈ ਜਿਹੜੀ ਰਿਫਰੈਸ਼ਮੈਂਟ ਲੈਣੀ ਹੁੰਦੀ ਹੈ ਤਾਂ ਕੀ ਉਹ ਠੀਕ ਤਰ੍ਹਾਂ ਦਾ ਬਿਹੇਵੀਅਰ ਰੱਖਦੇ ਹਨ